ਖੇਡਾਂ ਦੌਰਾਨ ਜਿਹੜੀ ਜ਼ਖਮੀ ਜਿਹੜੀ ਸਪੋਰਟਸ ਲੋਕਾਂ ਲਈ ਜਿਹੜੇ ਉਹ ਸਾਡੇ ਖੇਤਰ ਵਿੱਚ ਸੁਵਿਧਾਵਾਂ ਹੈਗੀਆਂ ਵੀ ਜੇ ਤੇ ਜਿਸ ਤਰ੍ਹਾਂ ਕਿਸੇ ਨੂੰ ਖੇਡਦੇ ਖੇਡਣ ਦੇ ਦੌਰਾਨ ਇਹ ਨਾ ਸੱਟ ਲੱਗ ਜਾਂਦੀ ਹੈ ਕਈ ਸੱਟਾਂ ਇਹੋ ਜਿਹੀ ਹੁੰਦੀਆਂ ਨੇ ਵੀ ਜਿਵੇਂ ਕਿ ਮਾਮੂਲੀ ਸੱਟ ਹੈ ਚੋਟ ਆਈ ਆ ਉਹਨੂੰ ਸਪਰੇਅ ਵਗੈਰਾ ਜਾਂ ਉਸ ਤਰ੍ਹਾਂ ਦੀ ਰੈਸਟ ਦੇ ਨਾਲ ਜਾਂ ਕੋਈ ਡੋਜ਼ ਦਿੱਤੀ ਜਾਂਦੀ ਹੈ ਵੀ ਉਹ ਸਹੀ ਹੋ ਜਾਂਦੀ ਜਲਦੀ ਕਈ ਵਾਰ ਇ ਇਸ ਤਰ੍ਹਾਂ ਨਹੀਂ ਹੁੰਦਾ ਕਿ ਸੱਟ ਜ਼ਿਆਦਾ ਹੁੰਦੀ ਆ ਫਿਰ ਉਸ ਤਰ੍ਹਾਂ ਉਹਨਾਂ ਦੀ ਸਹੂਲਤ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਹ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉੱਥੇ ਉਹਨਾਂ ਦਾ ਇਲਾਜ ਹੁੰਦਾ ਵਾ ਸਹੀ ਤਰੀਕੇ ਨਾਲ ਉਹ ਫਿਰ ਜਦੋਂ ਚੱਲਣ ਫਿਰਨ ਦੇ ਕਾਬਲ ਹੋ ਜਾਂਦੇ ਫਿਰ ਉਹ ਫਿਰ ਦੁਬਾਰਾ ਉਹ ਖੇਡਣ ਦੇ ਕਾਬਲ ਹੋ ਜਾਂਦੇ ਆ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਏ ਕਿ ਖੇਡਾਂ ਦੇ ਦੌਰਾਨ ਹੀ ਏ ਕਿਸੇ ਦਾ ਅੰਗ ਪੈਰ ਦਾ ਨੁਕਸਾਨ ਹੋ ਜਾਂਦਾ ਅੰਗਹੀਣ ਹੋ ਜਾਂਦਾ ਇੰਨਾਂ ਵਿਅਕਤੀ ਫਿਰ ਉਸਦੀ ਸਹੂਲਤ ਇਸ ਤਰਾਂ ਕੀਤੀ ਜਾਂਦੀ ਹੈ ਕਿ ਉਹ ਜਦੋਂ ਅੰਗਹੀਣ ਹੋਇਆ ਵਿਅਕਤੀ ਨਾ ਫਿਰ ਦੁਬਾਰਾ ਤਾਂ ਖੇਡ ਨਹੀਂ ਸਕਦਾ ਹਨ ਫਿਰ ਉਸਨੂੰ ਜਾਂ ਉਸ ਦੇ ਪਰਿਵਾਰ ਨੂੰ ਕਿਸੇ ਨੂੰ ਨੌਕਰੀ ਜਿਹੜਾ ਅੰਗਹੀਣ ਹੋਇਆ ਹੁੰਦਾ ਉਹਦੀ ਪੈਨਸ਼ਨ ਲਗਾਈ ਜਾਂਦੀ ਆ ਇਸ ਤਰਾਂ ਹੋਰ ਵੀ ਕਈ ਸਹੂਲਤਾਂ ਵਾ ਜਿਹੜੀਆਂ ਉਹਨਾਂ ਨੂੰ ਉਪਲਬਧ ਕਰਵਾਈਆਂ ਜਾਂਦੀਆਂ